ਹਾਂਜੀ ਜੇ ਆਪਾਂ ਭੰਗੜੇ ਦੇ ਪ੍ਰਦਰਸ਼ਨ ਵਾਲੀ ਗੱਲ ਕਰੀਏ ਤਾਂ ਭੰਗੜੇ ਨੂੰ ਜਿਹੜੇ ਕਿ ਪੰਜਾਬ ਦੇ ਲੋਕ ਹੈ ਬਾਹਰ ਦੇ ਲੋਕ ਹੈ ਬਹੁਤ ਜ਼ਿਆਦਾ ਲਾਈਕ ਕਰਦੇ ਆ ਮੈਂ ਵੀ ਬਹੁਤ ਜ਼ਿਆਦਾ ਲਾਈਕ ਕਰਦੀ ਹਾਂ ਕਿਉਂਕਿ ਜ਼ਿਆਦਾਤਰ ਜਦੋਂ ਬੰਦਾ ਜਾਂ ਕੋਈ ਵੀ ਲੇਡੀ ਭੰਗੜਾ ਕਰਦੇ ਹੈਗੇ ਆ ਤਾਂ ਉਹ ਟੀਮ ਬਣਾ ਕੇ ਕਰਦੇ ਹੈਗੇ ਆ ਤਾਂ ਉਹਨਾਂ ਦੇ ਜਿਹੜੇ ਕਿ ਕੁੜਤਾ ਪਜਾਮਾ ਜਾਂ ਕੁੜਤਾ ਚਾਦਰਾ ਪਾ ਕੇ ਜਿਹੜੇ ਕਿ ਜਦੋਂ ਉਹ ਭੰਗੜਾ ਕਰਦੇ ਆ ਲੇਡੀਜ ਪੰਜਾਬੀ ਸੂਟ ਪਾ ਕੇ ਕਰਦੀਆਂ ਤਾਂ ਉਹਨਾਂ ਦੇ ਕੱਪੜੇ ਜਿਹੜੇ ਕਿ ਬਹੁਤ ਚਮਕਦਾਰ ਹੁੰਦੇ ਆ ਅਤੇ ਜਿਹੜੇ ਵੀ ਲੋਕ ਮੰਨ ਕੇ ਚੱਲੋ ਵੀ ਉਹਨਾਂ ਨੂੰ ਦੇਖਦੇ ਹੈਗੇ ਆ ਭੰਗੜਾ ਕਰਦਿਆਂ ਨੂੰ ਤਾਂ ਉਹਨਾਂ ਨੂੰ ਉਹਨਾਂ ਨੂੰ ਵੇਖ ਕੇ ਵੀ ਇਹ ਲੱਗਦਾ ਹੈਗਾ ਕਿ ਅਸੀਂ ਵੀ ਭੰਗੜਾ ਕਰੀਏ ਅਸੀਂ ਵੀ ਇਹਨਾਂ ਦੀ ਤਰ੍ਹਾਂ ਬਣੀਏ ਹੈ ਨਾ ਤਾਂ ਲਾਈਕ ਕੀਤਾ ਬਹੁਤ ਜ਼ਿਆਦਾ ਲਾਈਕ ਕਰਦੀ ਹੈਗੀ ਹਾਂ ਭੰਗੜੇ ਨੂੰ ਤਾਂ ਉਹਨੂੰ ਸਾਫ ਸੁਥਰੇ ਕੱਪੜੇ ਦੇ ਵਿੱਚ ਜ਼ਿਆਦਾਤਰ ਭੰਗੜਾ ਪੰਜਾਬੀ ਸੂਟ 'ਚ ਅਤੇ ਕੁੜਤੇ ਚਾਦਰੇ ਨਾਲ ਹੀ ਜੱਚਦਾ ਹੈਗਾ ਤਾਂ ਜਦ ਇਹ ਭੰਗੜਾ ਦੂਰ ਦੂਰ ਤੋਂ ਮੰਨ ਕੇ ਚੱਲੋ ਵੀ ਜਦ ਵੀ ਜਾਂ ਕਿਤੇ ਵੀ ਭੰਗੜਾ ਕਰਦੇ ਆ ਤਾਂ ਲੋਕ ਬਹੁਤ ਦੂਰ ਦੂਰ ਤੋਂ ਦੇਖਣ ਆਉਂਦੇ ਆ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਹੈਗਾ ਅਗਲਾ ਵੇਖਣ ਵਾਲਾ ਵੀ ਇਹ ਸੋਚਦਾ ਹੈਗਾ ਵੀ ਸਾਨੂੰ ਵੀ ਭੰਗੜਾ ਕਰਨਾ ਚਾਹੀਦਾ ਹੈ ਨਾ ਕਿਉਂਕਿ ਗਿੱਧਾ ਭੰਗੜਾ ਹੀ ਰਹਿ ਗਿਆ ਹੈ ਨਾ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਲਾਈਕ ਕਰਦੇ ਆ ਲੋਕ ਕੋਲਜਾਂ 'ਚ ਵੀ ਇਹ ਜ਼ਿਆਦਾ ਚੱਲਦਾ ਹੈਗਾ ਤਾਂ ਆਈ ਲਾਈਕ ਇੱਟ ਭੰਗੜਾ